ਹਾਂਜੀ ਹਾਂਜੀ ਨਮਸਤੇ ਜੀ ਜੀ ਬੋਲੋ ਜੀ ਜੀ ਜ਼ਰੂਰ ਜੀ

ਮਤਲਬ ਕਿ ਉਪਜਾਉ ਹੋਣ ਕਰਕੇ ਪਹਿਲੇ ਪਹਿਲਾਂ ਸੀਗਾ ਪਹਿਲੇ ਸੀਗਾ ਕਿ ਪਹਿਲੇ ਲੋਕ ਹੱਥੀਂ ਕੰਮ ਕਰਦੇ ਸੀਗੇ ਠੀਕ ਹੈ ਪਹਿਲੇ ਹੱਥੀਂ ਕੰਮ ਕਰਨ ਦੇ ਨਾਲ ਉਸ 'ਚ ਜ਼ਿਆਦਾ ਟਾਈਮ ਲੱਗਦਾ ਸੀਗਾ ਹੁਣ ਹੁਣ ਸਰਕਾਰ ਨੇ ਮਸ਼ੀਨਾਂ ਬਣਾ ਤੀਆਂ ਮਸ਼ੀਨੀ ਯੁਗ ਕਰਤਾ ਵਾ ਜਿਹਦੇ ਕਰਕੇ ਜੇ ਜਿੱਦਾਂ ਹੁਣ ਹੁਣ ਦੇ ਟਾਈਮ 'ਚ ਜਿੱਦਾਂ ਵਿਸਾਖੀ 'ਤੇ ਲੋਕੀ ਕਣਕ ਦੀ ਵਢਾਈ ਕਰਦੇ ਆ ਅਤੇ ਮੌਸਮ ਦੇ ਚਲਦੇ ਜਿੱਦਾਂ ਖ਼ਰਾਬ ਹੈ ਮੌਸਮ ਅਗਰ ਆਪਾਂ ਕਿਸੇ ਨੂੰ ਵਢਾਈ ਕਰਨ ਦੇ ਲਈ ਲਾਉਂਦੇ ਹਾਂ ਅਤੇ ਉਹ ਇੱਕ ਖੇਤ ਨੂੰ ਘੱਟੋ ਘੱਟ ਵੀ ਦੋ ਤਿੰਨ ਦਿਨ ਦੇ ਵਿੱਚ ਕਵਰ ਕਰਦੇ ਹਨ ਜਦਕਿ ਮਸ਼ੀਨ ਦੇ ਮਸ਼ੀਨ ਹੀ ਹੁਣ ਕੰਬਾਈਨ ਹੋਣ ਦੇ ਕਰਕੇ ਉਹ ਅੱਧੇ ਘੰਟੇ 'ਚ ਉਹਨੂੰ ਕਵਰ ਕਰ ਲੈਂਦੇ ਆ ਹਾਂਜੀ ਹੋਰ ਜੀ ਜ਼ਰੂਰ ਓਕੇ ਜੀ